ਗਰਮੀ ਅਤੇ ਸਰਦੀਆਂ ਵਿੱਚ ਪੰਜਾਬ ਵਿੱਚ ਛੁੱਟੀਆਂ ਹੁੰਦੀਆਂ ਹਨ ਗਰਮੀਆਂ ਵਿੱਚ ਲੋਕ ਜ਼ਿਆਦਾਤਰ ਸ਼ਿਮਲੇ ਜੰਮੂ ਕਸ਼ਮੀਰ ਆਦਿ ਥਾਵਾਂ 'ਤੇ ਘੁੰਮਣ ਜਾਂਦੇ ਨੇ ਅਤੇ ਸਰਦੀਆਂ ਵਿੱਚ ਜੈਪੁਰ ਰਾਜਸਥਾਨ ਆਗਰਾ ਵਿੱਚ ਲੋਕ ਘੁੰਮਣ ਜਾਂਦੇ ਹਨ ਘੁੰਮਣ ਜਾਂਦੇ ਹਨ ਸਾਡੇ ਪੰਜਾਬ ਦੇ ਮੁੱਖ ਤਿਉਹਾਰ ਜਿਵੇਂ ਕਿ ਦਿਵਾਲੀ ਲੋਹੜੀ ਦੁਸ਼ਹਿਰਾ ਗੁਰਪੁਰਬ ਹੋਲੀ ਆਦਿ ਸਾਡੇ ਭਾਰਤ ਦੇ ਮੁੱਖ ਤਿਉਹਾਰ ਨੇ ਸਾਡੇ ਭਾਰਤ ਵਿੱਚ ਸਭ ਤੋਂ ਜ਼ਿਆਦਾ ਧੂਮ ਧਾਮ ਨਾਲ ਦਿਸ਼ ਦਿਵਾਲੀ ਮਨਾਈ ਜਾਂਦੀ ਹਨ ਦਿਵਾਲੀ ਮਨਾਈ ਜਾਂਦੀ ਹੈ ਦਿਵਾਲੀ ਵਿੱਚ ਬੱਚੇ ਬਹੁਤ ਸਾਰੇ ਪਟਾਕੇ ਵਜਾਉਂਦੇ ਨੇ ਅਤੇ ਸਭ ਦੇ ਘਰਾਂ ਵਿੱਚ ਮਠਿਆਈਆਂ ਆਉਂਦੀਆਂ ਨੇ ਇਹ ਦਿਵਾਲੀ ਦਿਵਾਲੀ ਕਿਸੇ ਧਰਮ ਕਿਸੇ ਧਰਮ ਉੱਤੇ ਲਾਗੂ ਨਹੀਂ ਹੁੰਦੀ ਕਿਉਂਕਿ ਇਹ ਦਿਵਾਲੀ ਸਭ ਲੋਕ ਮਿਲ ਕੇ ਸਭ ਧਰਮ ਦੇ ਲੋਕ ਆਪਸ ਵਿੱਚ ਮਿਲ ਕੇ ਤਿਉਹਾਰ ਮਨਾਉਂਦੇ ਹਨ ਦਿਵਾਲੀ ਦਿਵਾਲੀ ਵਿੱਚ ਸਾਰੇ ਨਵੇਂ ਕੱਪੜੇ ਪਾਉਂਦੇ ਹਨ ਅਤੇ ਰਾਤ ਨੂੰ ਲਕਸ਼ਮੀ ਮਾਤਾ ਦੀ ਪੂਜਾ ਕਰਦੇ ਹਨ